ਖੁੱਲੇ ਪਾਣੀ ਵਿੱਚ ਤੈਰਾਕੀ ਕਰਦੇ ਸਮੇਂ ਸਾਨੂੰ ਸੁਰੱਖਿਆ ਦਾ ਬਹੁਤ ਧਿਆਨ ਦੇਣਾ ਚਾਹੀਦਾ ਹੈ ਸਾਨੂੰ ਇਕੱਲੇ ਕਿਤੇ ਨਹੀਂ ਜਾਣਾ ਚਾਹੀਦਾ ਵਦਰੇ ਵਗਦੇ ਵਾਹ ਵਿੱਚ ਸਾਨੂੰ ਕਦੀ ਵੀ ਨਹੀਂ ਜਾਣਾ ਚਾਹੀਦਾ ਸਾਨੂੰ ਆਪਣੇ ਨਾਲ ਹਮੇਸ਼ਾ ਤੈਰਾਕੀਆਂ ਨੂੰ ਨਾਲ ਸਾ ਨਾਲ ਹੀ ਰਹਿਣਾ ਚਾਹੀਦਾ ਹੈ ਪਰ ਕਈ ਬੱਚੇ ਜਾਂ ਬਜ਼ੁਰਗ ਹੋਰ ਵੀ ਵਿਅਕਤੀ ਬਹੁਤ ਸੁਣਦੇ ਨਹੀ ਪਰ ਉਹ ਨਾ ਉਹ ਨਾ ਉਹ ਇਸੀ ਲਾਪਰਵਾਹੀ ਕਰਨਾ ਆਪਣੀ ਜਾਨ ਗਵਾ ਦਿੰਦੇ ਹਨ ਪਰ ਸਾਨੂੰ ਆਪਣੀ ਤੈਰਾਕੀਆਂ ਦੇ ਨਾਲ ਹੀ ਕਿਤੇ ਵੀ ਜਾਣਾ ਚਾਹੀਦਾ ਹੈ ਤੇਜ ਵਹਾਅ ਵਾਲੀਆਂ ਤੇਜ਼ ਵਾਹ ਵਾਲੀਆਂ ਲਹਿਰਾਂ ਤੇ ਚਟਾਨਾ ਤਿਲਕਣੀਆਂ ਚ ਤਿਲਕਣ ਵਾਲੀਆਂ ਚਟਾਨਾਂ ਤੇ ਵੀ ਸਾਨੂੰ ਤੈਰਾਕੀਆਂ ਨੂੰ ਨਾਲ ਲੈ ਕੇ ਹੀ ਜਾਣਾ ਚਾਹੀਦਾ ਹੈ ਇਸ ਨਾਲ ਸਾਡੀ ਸੁਰੱਖਿਆ ਵੱਧ ਜਾਂਦੀ ਹੈ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਸਮੇਂ ਕਿਸ ਕਿਸ ਚੀਜ਼ ਨੇ ਕਿਸ ਨੂੰ ਛੱਡਣਾ ਚਾਹੀਦਾ ਹੈ ਪਰ ਕਈ ਕਈ ਲੋਕ ਸੁਣਦੇ ਨਹੀਂ ਇਸ ਕਾਰਨ ਸਾਨੂੰ ਇਸ ਕਾਰਨ ਸਾਨੂੰ ਆਪਣੀ ਜਾਨ ਤੋਂ ਹੱਥ ਗਵਾਉਣਾ ਪੈਂਦਾ ਹੈ ਪਰ ਭਾਰਤ ਸਰਕਾਰ ਨੇ ਹੁਣ ਇਸ ਕੰਮ ਵੱਲ ਬਹੁਤ ਘੱਟ ਧਿਆਨ ਦੇ ਦਿੱਤਾ ਹੈ ਪਰ ਇਹ ਕੰਮ ਬਹੁਤ ਜਿਆਦਾ ਪਰ ਹੁਣ ਅੱਜ ਕੱਲ ਦੇ ਸਮੇਂ ਵਿੱਚ ਇਹ ਕੰਮ ਬਹੁਤ ਜਿਆਦਾ ਵੱਧ ਗਿਆ ਹੈ ਕੁਝ ਤਰੀਕੇ ਕਾਰਨ ਗੱਡੀਆਂ ਪਾਣੀਆਂ ਜਿਵੇਂ ਤਿਲਕਣ ਵਾਲੀਆਂ ਚਟਾਨਾਂ ਹੋਰ ਵਹਾਅ ਵਾਲੀਆਂ ਦੁਕਾਨਾਂ ਚ ਚਟਕਾਨਾ ਬਹੁਤ ਕੁਰਨ ਕਰਨੀਆਂ ਪੈਂਦੀਆਂ ਹਨ ਪਰ ਭਾਰਤ ਸਰਕਾਰ ਨੂੰ ਇਹ ਬੰਦ ਕਰਨਾ ਚਾਹੀਦਾ ਹੈ ਇਸ ਵਿੱਚ ਕਈ ਬੱਚਿਆਂ ਬਜ਼ੁਰਗਾਂ ਜਾਂ ਹੋਰ ਵੀ ਵਿਅਕਤੀਆਂ ਦੀ ਜਾਨ ਚਲੀ ਗਈ ਹੈ